ਹਾਂਜੀ ਮੈਮ ਮੈਮ ਮੈਂ ਇਹ ਪੁੱਛਣਾ ਸੀਗਾ ਮੈਂ ਇੱਕ ਫਾਰਮਰ ਗੱਲ ਕਰ ਰਿਹਾ ਸੀ ਅਤੇ ਮੈਮ ਮੈਂ ਪੁੱਛਣਾ ਸੀਗਾ ਵੀ ਜਿਹੜੀਆਂ ਫਸਲਾਂ ਨੇ ਜਿਹੜੀਆਂ ਫਸਲਾਂ ਨੇ ਆਪਣੀਆਂ ਉਹ ਕਿਹੜੇ ਕਿਹੜੇ ਟਾਈਮ 'ਤੇ ਲੱਗਦੀਆਂ ਹੈ ਸਹੀ ਮਤਲਬ ਠੀਕ ਹੈ ਮੈਮ ਓਕੇ ਮੈਮ ਹਾਂਜੀ

ਠੀਕ ਹੈ ਮੈਮ ਹਾਂਜੀ ਮੈਮ ਠੀਕ ਹੈ ਮੈਮ ਓਕੇ ਮੈਮ ਠੀਕ ਹੈ ਮੈਮ ਮੈਮ ਇਹ ਇਨਫੋਰਮੇਸ਼ਨ ਮੇਰੀ ਈਮੇਲ 'ਤੇ ਸੈਂਡ ਕਰ ਸਕਦੇ ਹੋ ਤੁਸੀਂ ਓਕੇ ਠੀਕ ਹੈ ਮੈਮ ਅਸੀਂ ਔ ਔਫਿਸ 'ਚ ਵਿਜਿਟ ਕਰ ਸਕਦੇ ਹਾਂ ਮੈਮ ਠੀਕ ਹੈ ਮੈਮ ਠੀਕ ਹੈ ਮੈਮ ਠੀਕ ਹੈ ਮੈਮ ਠੀਕ ਹੈ ਮੈਮ ਥੈਂਕ ਯੂ ਮੈਮ